ਨਹੀਂ ਮੈਂ ਯੋਗਾ ਦੀ ਕਿਸੇ ਸੈਲੀ ਦੀ ਖੋਜ ਨਹੀਂ ਕੀਤੀ ਹੈ ਨਾ ਹੀ ਮੈਂ ਯੋਗਾ ਦਾ ਕੋਈ ਅਧਿਆਪਕ ਹਾਂ ਪਰ ਮੈਂ ਯੋਗਾ ਕਰ ਦਿਆਂ ਨੂੰ ਦੇਖਿਆ ਹੈ ਯੋਗਾ ਕਰਦਿਆਂ ਦੀਆਂ ਵੀਡੀਓ ਦੇਖੀਆਂ ਹਨ ਅਕਸਰ ਹੀ ਟੈਲੀਵਿਜ਼ਨ ਚੈਨਲ ਉੱਪਰ ਯੋਗਾ ਕਰਦਿਆਂ ਦੀਆਂ ਵੀ ਵੀਡੀਓ ਚਲਦੀਆਂ ਹਨ ਯੋਗਾ ਕਰਨਾ ਸਿਖਾਇਆ ਜਾਂਦਾ ਹੈ ਯੂਟੀਊਬ ਉੱਪਰ ਵੀ ਯੋਗਾ ਸਿੱਖਣ ਦੇ ਕਈ ਚੈਨਲ ਹਨ ਅਸੀਂ ਉਸ ਤੋਂ ਵੀ ਯੋਗਾ ਸਿੱਖ ਸਕਦੇ ਹਾਂ ਮੈਂ ਜਦੋਂ ਵੀ ਯੋਗਾ ਕੀਤਾ ਹੈ ਤਾਂ ਯੂਟੀਊਬ ਤੋਂ ਦੇਖ ਕੇ ਹੀ ਕੀਤਾ ਹੈ ਇਸੇ ਤਰਾਂ ਟੀਵੀ ਤੋਂ ਵੀ ਕਈ ਵਾਰ ਯੋਗਾ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਮੈਂ ਵਧੀਆ ਯੋਗਾ ਦੇ ਆਸਨ ਕਰ ਲੈਂਦਾ ਹਾਂ ਮੈਨੂੰ ਕਪਾਲ ਭਾਰਤੀ ਅਨਲੋਮ ਬਿਲੋਂਗ ਕਰਨਾ ਬਹੁਤ ਵਧੀਆ ਲੱਗਦਾ ਹੈ ਇਸ ਤੋਂ ਬਿਨਾਂ ਜਿਆਦਾਤਰ ਯੋਗਾ ਦੀ ਨਾਵਾਂ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈ ਪਰ ਮੈਨੂੰ ਯੋਗਾ ਕਰਨ ਦੀਆਂ ਕਈ ਗਤੀਵਿਧੀਆਂ ਬਾਰੇ ਜਾਣਕਾਰੀ ਜਰੂਰ ਹੈ ਯੋਗਾ ਇੱਕ ਚੰਗੀ ਗਤੀਵਿਧੀ ਹੈ ਜੋ ਸਾਨੂੰ ਅਪਣਾਉਣੀ ਚਾਹੀਦੀ ਹੈ ਜੇਕਰ ਅਸੀਂ ਯੋਗਾ ਕਰਦੇ ਰਹਾਂਗੇ ਤਾਂ ਸਾਡਾ ਸਰੀਰ ਨਰੋਆ ਤੰਦਰੁਸਤ ਰਹੇਗਾ ਅਸੀਂ ਬਿਮਾਰੀਆਂ ਤੋਂ ਦੂਰ ਰਵਾਂਗੇ ਬਿਮਾਰ ਨਹੀਂ ਹੋਵਾਂਗੇ ਅੰਗਰੇਜ਼ੀ ਦਵਾਈਆਂ ਤੋਂ ਬਚੇ ਰਹਾਂਗੇ ਅੰਗਰੇਜ਼ੀ ਦਵਾਈਆਂ ਸਾਨੂੰ ਬਿਮਾਰ ਹੋਣ ਤੋਂ ਬਾਅਦ ਤੰਦਰੁਸਤ ਕਰਨ ਵਿੱਚ ਕੁਝ ਹੱਦ ਤੱਕ ਸਹਾਈ ਹੁੰਦੀਆਂ ਹਨ ਪਰ ਯੋਗਾ ਸਾਨੂੰ ਬਿਮਾਰ ਹੋਣ ਤੋਂ ਹੀ ਬਚਾਉਂਦਾ ਹੈ ਯੋਗਾ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੈਨੂੰ ਪਸੰਦ ਹੈ ਇਸ ਲਈ ਮੈਂ ਸਵੇਰ ਤੜਕਸਾਰ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਾ ਸਾਹਿਬ ਜਾਂਦਾ ਹਾਂ ਆ ਕੇ ਸੈਰ ਕਰਨ ਤੋਂ ਬਾਅਦ ਘਰ ਬੈਠ ਕੇ ਜੋ ਮੈਨੂੰ ਜੋ ਮੈਨੂੰ ਯੋਗਾ ਦੇ ਆਸਣ ਆਉਂਦੇ ਹਨ ਉਹ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਕਸਰ ਹੀ ਮੈਂ ਯੋਗਾ ਕਰਦਾ ਹਾਂ